ਮੈਂ ਪੰਜਾਬੀ ਗੀਤ ਸੁਣਨਾ ਬਹੁਤ ਪਸੰਦ ਕਰਦੀ ਹਾਂ ਜਦੋਂ ਵੀ ਮੇਰੇ ਤੋਂ ਵਿਹਲਾ ਟਾਈਮ ਹੋਵੇ ਤਾਂ ਉਦੋਂ ਮੈਂ ਸੰਗੀਤ ਸੁਣਨਾ ਪਸੰਦ ਕਰਦੀ ਹਾਂ ਮੈਂ ਬਹੁਤ ਹੀ ਤਰ੍ਹਾਂ ਦੇ ਗੀਤ ਸੁਣਦੀ ਹਾਂ ਜਿਵੇਂ ਕਿ ਪੰਜਾਬੀ ਹਿੰਦੀ ਪੋਪ ਸੌਂਗ ਅਤੇ ਹੋਰ ਵੀ ਬਹੁਤ ਗੀਤ ਸੁਣਨਾ ਪਸੰਦ ਕਰਦੀ ਹਾਂ ਪਰ ਮੇਰੀ ਮੇਨ ਲਿਸਟ ਵਿੱਚ ਹਮੇਸ਼ਾ ਹੀ ਪੰਜਾਬੀ ਗੀਤ ਹੀ ਹੁੰਦੇ ਹਨ ਮੇਰੇ ਬਹੁਤ ਸਾਰੇ ਮਨ ਪਸੰਦ ਗਾਇਕ ਹਨ ਜਿਵੇਂ ਕਿ ਦਿਲਜੀਤ ਦੋਸਾਂਝ ਤਰਸੇਮ ਜੱਸੜ ਨਿਮਰਤ ਖਹਿਰਾ ਅਤੇ ਹੋਰ ਵੀ ਬਹੁਤ ਇਹਨਾਂ ਦੇ ਮੈਂ ਗਾਣੇ ਬਹੁਤ ਹੀ ਸੁਣਨਾ ਪਸੰਦ ਕਰਦੀ ਹਾਂ ਇਹ ਮੇਰੇ ਮੇਨ ਗਾਇਕ ਹਨ ਮੈਂ ਆਪਣੇ ਫਰੀ ਟਾਈਮ ਵਿੱਚ ਇਹਨਾਂ ਨੂੰ ਸੁਣਨਾ ਪਸੰਦ ਕਰਦੀ ਹਾਂ ਇਹਨਾਂ ਦੇ ਗਾਣੇ ਸੁਣ ਕੇ ਮੈਨੂੰ ਬਹੁਤ ਹੀ ਫੁਰਤੀਲਾਪਨ ਮਹਿਸੂਸ ਹੁੰਦਾ ਹੈ ਅਤੇ ਜਿਸ ਟਾਈਮ ਵੀ ਮੈਂ ਬੋਰਿੰਗ ਫੀਲ ਕਰਾਂ ਮੈਂ ਇਹਨਾਂ ਗਾਇਕਾਂ ਦੇ ਗੀਤ ਸੁਣਨਾ ਹੀ ਪਸੰਦ ਕਰਦੀ ਹਾਂ ਸਾਡੀ ਕਿ ਜਿਵੇਂ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਗਾਇਕ ਹਨ ਜੋ ਕਿ ਆਪਣੇ ਅਖਾੜੇ ਵੀ ਲਗਾਉਂਦੇ ਹਨ ਵੱਖਰੇ ਵੱਖਰੇ ਸਥਾਨਾਂ 'ਤੇ ਜਿਵੇਂ ਕਿ ਮੇਲਿਆਂ 'ਤੇ ਵਿਵਾ ਵਿਆਹਾਂ 'ਤੇ ਲੋਕ ਪ੍ਰੋਗਰਾਮਾਂ 'ਤੇ ਇਹਨਾਂ ਗਾਇਕਾਂ ਨੂੰ ਸੱਦਦੇ ਹਨ ਅਤੇ ਇਹ ਬਹੁਤ ਹੀ ਆਪਣੇ ਹੁਨਰ ਨਾਲ ਬਹੁਤ ਹੀ ਰੌਣਕਾਂ ਲਗਾਉਂਦੇ ਹਨ ਪੰਜਾਬੀ ਗੀਤਾਂ ਦਾ ਬਹੁਤ ਹੀ ਨਾਮ ਹੈ ਪੂਰੀ ਦੁਨੀਆਂ ਦੇ ਲੋਕ ਇਹਨਾਂ ਨੂੰ ਸੁਣਨਾ ਪਸੰਦ ਕਰਦੇ ਹਨ ਅਤੇ ਪੰਜਾਬੀ ਗੀਤ ਬਹੁਤ ਹੀ ਵੱਖਰਾ ਹੀ ਮਤਲਬ ਰੱਖਦੇ ਹਨ ਅਤੇ ਮੈਂ ਵੀ ਪੰਜਾਬੀ ਗੀਤਾਂ ਨੂੰ ਸੁਣਨਾ ਹੀ ਪਸੰਦ ਕਰਦੀ ਹਾਂ